ਸਾਡੇ ਖੇਤਰ ਦੇ ਵਿੱਚ ਹੋਰ ਬੜੇ ਨਾਂ ਹੈਗੇ ਹਨ ਖੇਡ ਦੀਆਂ ਟੀਮਾਂ ਦੇ ਵਿੱਚ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਹੈਗੇ ਸੀ ਕੀ ਕਹਿੰਦੇ ਮਿਲਖਾ ਸਿੰਘ ਜੀ ਬੜੇ ਮਸ਼ਹੂਰ ਹੋਏ ਜਿਹੜੇ ਕਿ ਦੌੜ ਦੇ ਵਿੱਚ ਬਣੇ ਵਧੀਆ ਪਲੇਅਰ ਹਨ ਔਰ ਕ੍ਰਿਕਟ ਦੇ ਵਿੱਚ ਯੁਵਰਾਜ ਸਿੰਘ ਹੋ ਗਿਆ ਅਤੇ ਇਹ ਇਹ ਕੀ ਕਹਿੰਦੇ ਨੇ ਉਹ ਹਰਭਜਨ ਸਿੰਘ ਹੋ ਗਿਆ ਹੋਰ ਵੀ ਬੜੇ ਪੰਜਾਬ 'ਚੋਂ ਖਿਡਾਰੀ ਨਿਕਲੇ ਹਨ ਵੱਖੋ ਵੱਖ ਅ ਗੇਮਾਂ ਦੇ ਹੋਕੀ ਦੇ ਪਲੇਅਰ ਵੀ ਕਾਫੀ ਸਾਰੇ ਹੈਗੇ ਹਨ ਹੋਰ ਵੀ ਬੜੇ ਪਲੇਅਰ ਜਿਹੜੇ ਹੈ ਪੰਜਾਬ 'ਚੋਂ ਨਿਕਲ ਕੇ ਗਏ ਹਨ ਅੱਜ ਕੱਲ੍ਹ ਹੁਣ ਅੱਜ ਕੱਲ੍ਹ ਦੇਖਿਆ ਪੰਜਾਬੀ ਪਲੇਅਰ ਕਾਫੀ ਹੈਗੇ ਹੈ ਜਿਸ ਤਰਾਂ ਅਰਸ਼ਦੀਪ ਸਿੰਘ ਵੀ ਬੜਾ ਲੜਕਾ ਅੱਛਾ ਅੱਜ ਕੱਲ੍ਹ ਜਿਹੜਾ ਕਿ ਕ੍ਰਿਕਟ ਖੇਡ ਰਿਹਾ ਉਹ ਵੀ ਪੰਜਾਬ ਤੋਂ ਹੀ ਹੈ ਔਰ ਉਹ ਵੀ ਕ੍ਰਿਕਟ ਬੜਾ ਅੱਛਾ ਖੇਡਦਾ ਹੈ ਕ੍ਰਿਕਟ ਹੋਰ ਵੀ ਬੜੀਆਂ ਗੇਮਾਂ ਹਨ ਲੇਕਿਨ ਕ੍ਰਿਕਟ ਦੇ ਵਿੱਚ ਕ੍ਰਿਕਟ ਦੀ ਗੇਮ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਜਿਹੜੇ ਖਿਡਾਰੀ ਹਨ ਉਹ ਕ੍ਰਿਕਟ ਦੀ ਗੇਮ ਦੇ ਵਿੱਚ ਹੀ ਪੰਜਾਬ ਦੇ ਵਿੱਚ ਗਏ ਹਨ ਔਰ ਵੀ ਕਾਫੀ ਸਾਰੀ ਗੇਮਾਂ ਦੇ ਵਿੱਚ ਲੜਕੇ ਜਿਹੜੇ ਨੇ ਪੰਜਾਬ ਦੇ ਵਿੱਚੋਂ ਚੁਣੇ ਜਾਂਦੇ ਹਨ ਹੋਕੀ ਦੇ ਪਲੇਅਰਾਂ 'ਚ ਵੀ ਕਾਫੀ ਸਾਰੇ ਪਲੇਅਰ ਹੈਗੇ ਨੇ ਜਿਹੜੇ ਤਕਰੀਬਨ ਪੰਜਾਬੀ ਹੀ ਹਨ ਸਾਰੇ